ਹਾਂਜੀ ਕਿੱਥੋਂ ਬੋਲਦੇ ਪਏ ਹਾਂਜੀ ਹਾਂਜੀ ਡੈਰੀ ਤੋਂ ਬੋਲਦੇ ਹੋ ਡੈਰੀ 'ਤੇ ਸਾਡੇ ਵੀ ਜਿਵੇਂ ਤੁਹਾਨੂੰ ਕੀ ਮੱਝ ਦਾ ਵੀ ਮਿਲਦਾ ਹੈ ਗੋ ਗੋਕਾ ਵੀ ਮਿਲਦਾ ਹੈ ਬੱਕਰੀ ਦਾ ਵੀ ਮਿਲ ਜਾਂਦਾ ਹੈ ਭੇਡ ਦਾ ਵੀ ਮਿਲ ਜਾਂਦਾ ਹੈ ਮੱਝ ਦਾ ਤਾਂ ਹੈਗਾ ਸੱਠ ਰੁਪਈਏ ਅਸੀਂ ਦੇਈ ਜਾਂਦੇ ਆ ਅਤੇ ਚੱਲੀ ਬਾਹਰ ਸੱਤਰ ਵੀ ਜਾਂਦਾ ਪਰ ਅਸੀਂ ਸੱਠ ਹੀ ਲਾਉਂਦੇ ਹਾਂ ਗਾਂ ਦਾ ਅਸੀਂ ਦਿੰਦੇ ਪੰਤਾਲੀ ਰੁਪਈਏ ਵਧੀਆ ਵਧੀਆ ਪਿਓਰ ਦੇਸੀ ਘਿਓ ਵੀ ਰੱਖਦੇ ਹਾਂ ਭਾਵੇ ਗੋਕਾ ਲੈ ਲਓ ਭਾਵੇਂ ਮੱਝ ਦਾ ਲੈ ਲਓ ਅਤੇ ਨਹੀਂ ਜੀ ਮੱਝ ਦਾ ਘਿਓ ਤਾਂ ਹੈਗਾ ਸੱਤ ਸੌ ਨੂੰ ਕਿਲੋ ਗਾਂ ਦਾ ਤਾਂ ਆਹੀ ਹੈਗਾ ਸਾਢੇ ਕੁ ਪੰਜ ਸੌ ਨੂੰ ਕਿਲੋ ਕ੍ਰੀਮ ਵੀ ਮਿਲ ਜਾਂਦੀ ਹੈ ਦਹੀਂ ਵੀ ਮਿਲ ਜਾਂਦਾ ਏ ਜੇ ਦਹੀਂ ਲੈਣਾ ਹੋਵੇ ਪਨੀਰ ਵੀ ਮਿਲਦਾ ਸਾਡੀ ਵਿੱਚ ਡੈਰੀ ਤੋਂ ਵਧੀਆ ਤਾਜ਼ਾ ਮੱਖਣ ਵੀ ਮਿਲਦਾ ਵਧੀਆ ਵਧੀਆ ਤਾਜ਼ਾ ਮੱਖਣ ਹਰੇਕ ਚੀਜ਼ ਮਿਲਦੀ ਹੈ ਡੈਰੀ ਤੋਂ ਹਾਂ ਹਾਂ ਉਹ ਵੀ ਮਿਲਦੀ ਹੈ ਸੁੱਕਾ ਦੁੱਧ ਵੀ ਮਿਲ ਜਾਂਦਾ ਵਧੀਆ ਹੁੰਦਾ ਸੁੱਕਾ ਹਾਂ ਵਧੀਆ ਵਧੀਆ ਰੱਖਦੇ ਹੈ ਜਿਹੜੀ ਚੀਜ਼ ਮਰਜ਼ੀ ਲੈ ਕੇ ਜਾਓ ਹਾਂਜੀ ਲੈ ਲਿਓ ਮਿਲਜੂਗਾ ਹਾਂ ਹਾਂ ਸ਼ਾਮ ਨੂੰ ਵੀ ਮਿਲ ਜਾਂਦਾ ਸਵੇਰੇ ਜਿਸ ਟਾਈਮ ਤੁਹਾਨੂੰ ਲੋੜ ਆ ਤੁਸੀਂ ਫੋਨ ਕਰੋ ਸਾਨੂੰ ਮਿਲਜੂਗਾ ਮੱਝ ਦਾ ਸੱਠ ਰੁਪਈਏ ਕਿਲੋ ਗਾਂ ਦਾ ਪੰਤਾਲੀ ਹਾਂ ਤੁਹਾਨੂੰ ਮਿਲ ਹੀ ਜਾਊਗਾ ਪੰਜ ਸਾਢੇ ਪੰਜ ਤਕਰੀਬਨ ਵਿੱਚ ਸ਼ਾਮ ਸ਼ਾਮ ਨੂੰ ਸ਼ਾਮ ਨੂੰ ਸ਼ਾਮ ਨੂੰ ਤੜਕੇ ਤਾਂ ਥੋੜ੍ਹਾ ਜਿਹਾ ਲੇਟ ਮਿਲੂਗਾ ਸਾਢੇ ਛੇ ਵਜੇ ਮਿਲੂਗਾ ਡੈਰੀ ਤਾਂ ਫਿਰ ਉਹ ਵੈਸ ਸਵੇਰਾ ਹੀ ਖੁੱਲ ਜਾਂਦੀ ਹੈ ਸ਼ਾਮ ਨੂੰ ਤਾਂ ਅਤੇ ਸਵੇਰੇ ਵੀ ਸਵੇਆ ਹੀ ਖੋਲ੍ਹਦੇ ਹਾਂ ਡੈਰੀ ਤਾਂ ਅਤੇ ਉਹ ਫਿਰ ਦੁੱਧ ਫਿਰ ਜਿਵੇਂ ਜਿਵੇਂ ਆਈ ਜਾਂਦਾ ਘਰਾਂ ਦਾ ਚੰਗਾ ਵਧੀਆ ਅਤੇ ਉਵੇਂ ਉਵੇਂ ਦੇਈ ਜਾਂਦੀ ਹਾਂ ਵਧੀਆ ਵਧੀਆ ਕੰਡਾ ਕੋਲ ਹੋਊਗਾ ਆਪਦਾ ਕੋਲ ਤਲਾ ਕੇ ਲੈ ਕੇ ਜਾਓ ਬਹੁਤ ਵਧੀਆ ਦੁੱਧ ਹੋਉਗਾ ਠੀਕ ਆ